ਯੂ ਐੱਫ ਓ ਦੀ ਗੱਲ ਕੀਤੀ ਜਾਵੇ ਮੈਂ ਆਪਣੀ ਲਾਈਫ 'ਤੇ ਹਾਲੇ ਤੱਕ ਕਦੇ ਨਹੀਂ ਦੇਖਿਆ ਯੂ ਐੱਫ ਓ ਇਹਦੀਆਂ ਅਫਵਾਹ ਹੀ ਸੁਣੀਆਂ ਹਨ ਹੁਣ ਤੱਕਰ ਅਤੇ ਬਾਕੀ ਸਰਕਾਰ ਕਹਿ ਤਾਂ ਰਹੀ ਆ ਵੀ ਹੁਣ ਚੰਨ ਤੱਕਰ ਜਾਣ ਦੀ ਗੱਲ ਵੀ ਆਪਾਂ ਉੱਥੇ ਜੇ ਪਾਣੀ ਮਿਲ ਗਿਆ ਜਾਂ ਉੱਥੇ ਆਪਾਂ ਮੁੱਖ ਜੀਵਨ ਜੀਊਗਾ ਤੁਹਾਨੂੰ ਪਤਾ ਹੀ ਆ ਜਿੱਦਾਂ ਕਿ ਸੱਤਰ ਸੱਤਰ ਪ੍ਰਸੈਂਟ ਬੰਦੇ ਨੂੰ ਜਿਊਣ ਵਾਸਤੇ ਪਾਣੀ ਬੋਡੀ 'ਚ ਚਾਹੀਦਾ ਏ ਆ ਜੋ ਕਿ ਜੇ ਉੱਥੇ ਸਾਨੂੰ ਸੰਭਵ ਹੋ ਗਿਆ ਚੰਨ ਵਿੱਚ ਅਸੀਂ ਉੱਥੇ ਆਪਣਾ ਰਹਿਣਾ ਸ਼ੁਰੂ ਕਰੀਏ ਅਤੇ ਜੀਵਨ ਦਰੱਖਤ ਪੇੜ ਪੌਦੇ ਖੇਤੀਬਾੜੀ ਕਰੀਏ ਜਿਦਾਂ ਕਿ ਸਾਨੂੰ ਜੋ ਕੇ ਸਾਡੇ ਸਾਹ ਲੈਣ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਚੰਨ ਵਿੱਚ ਅਸੀਂ ਇਹੀ ਚਾਹੁੰਦੇ ਹਨ ਪਰ ਯੂ ਐੱਫ ਓ ਸਨੀ ਸੁਣਿਆ ਅਸੀਂ ਇਹ ਅਫਵਾਹਾਂ ਹੀ ਹਨ ਮੈਂ ਕਦੇ ਆਪਣੀ ਅੱਖੀ ਨਹੀਂ ਵੇਖੇ ਯੂ ਐੱਫ ਓ